ਵੈਸੇ ਤਾਂ ਅੱਜ ਕੱਲ੍ਹ ਹਰ ਕੋਈ ਕਾਰੋਬਾਰ ਆਪਣਾ ਖੋਲ੍ਹਦਾ ਹੈ ਹਰ ਕੋਈ ਕਾਰੋਬਾਰ ਦੇ ਵਿੱਚ ਆਪਣਾ ਹੱਥ ਤੇਜ਼ ਕਰਨਾ ਚਾਹੁੰਦਾ ਹੈ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਕਾਰੋਬਾਰ ਵੈਸੇ ਤਾਂ ਹਰ ਵਾਰੀ ਤੁਹਾਨੂੰ ਫਾਇਦਾ ਵੀ ਨਹੀਂ ਦਿੰਦਾ ਅਤੇ ਹਰ ਵਾਰੀ ਤੁਹਾਨੂੰ ਨੁਕਸਾਨ ਵੀ ਨਹੀਂ ਦਿੰਦਾ ਕਈ ਵਾਰੀ ਇਦਾਂ ਵੀ ਹੋਏਗਾ ਕੀ ਤੁਹਾਨੂੰ ਨੁਕਸਾਨ ਜ਼ਿਆਦਾ ਹੋ ਜਾਏਗਾ ਅਤੇ ਫਾਇਦਾ ਘੱਟ ਹੋਏਗਾ ਪਰ ਕਈ ਵਾਰੀ ਇੱਦਾਂ ਵੀ ਹੋਏਗਾ ਕਿ ਤੁਹਾਨੂੰ ਫਾਇਦਾ ਜ਼ਿਆਦਾ ਹੋਏਗਾ ਅਤੇ ਨੁਕਸਾਨ ਘੱਟ ਹੋਏਗਾ ਕਾਰੋਬਾਰ ਵੈਸੇ ਤੁਹਾਨੂੰ ਨੁਕਸਾਨ ਵੀ ਕਈ ਵਾਰੀ ਦਿੰਦਾ ਹੈ ਅਤੇ ਫਾਇਦਾ ਵੀ ਬਹੁਤ ਜ਼ਿਆਦਾ ਦਿੰਦਾ ਹੈ ਕਾਰੋਬਾਰ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹਾ ਆਪਣਾ ਫਾਇਦਾ ਕਰਾਉਣਾ ਚਾਹੁੰਦੇ ਹੋ ਜਾਂ ਨੁਕਸਾਨ ਕਰਾਉਣਾ ਚਾਹੁੰਦੇ ਹੋ ਫਾਇਦੇ ਵਾਲਾ ਉਹ ਕਾਰੋਬਾਰ ਆ ਜੋ ਇੱਥੇ ਉਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੋਵੇ ਜਿੱਦਾਂ ਮੰਨ ਲਓ ਕਿ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਗਏ ਹੋ ਉੱਥੇ ਉਹ ਇਹੋ ਜਿਹੀ ਚੀਜ਼ ਦਾ ਕਾਰੋਬਾਰ ਨਹੀਂ ਚੱਲਣ ਡਿਆ ਜੋ ਤੁਸੀਂ ਕਰ ਸਕਦੇ ਹੋ ਇਸਦਾ ਮਤਲਬ ਕਿ ਤੁਹਾਨੂੰ ਉੱਥੇ ਮੁਨਾਫ਼ਾ ਜ਼ਿਆਦਾ ਮਿਲੇਗਾ ਪਰ ਤੁਸੀਂ ਇਹੋ ਜਿਹੀ ਜਗ੍ਹਾ ਕਾਰੋਬਾਰ ਖੋਲ੍ਹੋਗੇ ਜਿੱਥੇ ਉਹ ਤਾਂ ਪਹਿਲਾਂ ਬਹੁਤ ਜ਼ਿਆਦਾ ਦੁਕਾਨ ਖੁੱਲ੍ਹਦੀਆਂ ਨੇ ਅਤੇ ਤੁਸੀਂ ਕਿੱਥੋਂ ਕਰ ਲਉਗੇ ਕਾਰੋਬਾਰ ਕਾਰੋਬਾਰ ਬੇਸਿਕਲੀ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹੀ ਜਗ੍ਹਾ 'ਤੇ ਖੋਲ੍ਹ ਰਹੇ ਹੋ ਤੁਸੀਂ ਇਹੋ ਜਿਹੀ ਕੋਈ ਜਗ੍ਹਾ 'ਤੇ ਖੋਲ੍ਹ ਰਹੇ ਹੋ ਜਿੱਥੇ ਉਹਦੀ ਜ਼ਿਆਦਾ ਉਹ ਆ ਡਿਮਾਂਡ ਹੈ ਜਾਂ ਤੁਸੀਂ ਉੱਥੇ ਖੋਲ੍ਹ ਰਹੇ ਹੋ ਜਿੱਥੇ ਉਹਦੀ ਡਿਮਾਂਡ ਨਹੀਂ ਹੈਗੀ ਹੈ ਕਾਰੋਬਾਰ ਵੈਸੇ ਤਾਂ ਮੈਂ ਚਾਹੁੰਦਾ ਕਿ ਜਿੱਦਾਂ ਪਿੰਡਾਂ ਵਗੈਰਾ ਦੇ ਮਾਮਲੇ ਦੇ ਵਿੱਚ ਵੈਸੇ ਡੇਅਰੀ ਦਾ ਕੰਮ ਬਹੁਤ ਜ਼ਿਆਦਾ ਚੱਲ ਸਕਦਾ ਹੈ ਕਿਉਂਕਿ ਕਰਿਆਨਾ ਬਹੁਤ ਜ਼ਿਆਦਾ ਹੋ ਗਿਆ ਹੈ ਤੁਸੀਂ ਜਿੱਥੇ ਵੀ ਜਾਓਗੇ ਕਰਿਆਨਾ ਤੁਹਾਨੂੰ ਹਰ ਪਾਸੇ ਮਿਲੇਗਾ ਇਸ ਲਈ ਤੁਹਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਜਾਂ ਉੱਥੇ ਡੇਅਰੀ ਦਾ ਕੰਮ ਖੋਲ੍ਹ ਲਓ ਜਾਂ ਕੋਈ ਇਹੋ ਜਿਹੇ ਕੰਮ ਖੋਲ੍ਹ ਲਓ ਜੋ ਕੋਈ ਨਹੀਂ ਕਰਦਾ ਪਿਆ ਕੋਈ ਨਹੀਂ ਕਰਦਾ ਪਿਆ ਮਤਲਬ ਇਹੋ ਜਿਹਾ ਜਿੱਦਾਂ ਕਿ ਆਪਣੇ ਕਿਸਾਨ ਭਾਈ ਜਿੰਨੇ ਵੀ ਹੈਗੇ ਨੇ ਉਹਨਾਂ ਲਈ ਵੀ ਤੁਸੀਂ ਉਹ ਆਪਣੇ ਖਾਦ ਵਗੈਰਾ ਦਾ ਜਾਂ ਉਹਦਾ ਇੰਤਜ਼ਾਮ ਕਰ ਸਕਦੇ ਹੋ ਉਹ ਵੀ ਭ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸ਼ਹਿਰ ਵਗੈਰਾ ਦੇ ਵਿੱਚ ਤਾਂ ਵੈਸੇ ਬਹੁਤ ਸਾਰੇ ਕਾਰੋਬਾਰ ਚੱਲ ਜਾਂਦੇ ਨੇ ਬਸ ਤੁਹਾਨੂੰ ਉੱਥੇ ਦੇਖਣਾ ਹੈ ਕਿ ਕਿਹੋ ਜਿਹੀ ਜਗ੍ਹਾ 'ਤੇ ਤੁਸੀਂ ਆਪਣਾ ਕਾਰੋਬਾਰ ਚਲਾਉਣਾ ਹੈ ਕਾਰੋਬਾਰ ਚਲਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਬਸ ਕਾਰੋਬਾਰ ਸਹੀ ਜਗ੍ਹਾ 'ਤੇ ਸਹੀ ਤਰੀਕੇ ਨਾਲ ਚਲਾਉਣਾ ਹੈ ਬਾਕੀ ਥੈਂਕ ਯੂ